ਮੈਂ ਚਿਮਨੇ ਵਾਲੇ ਦਾ ਨਿਵਾਸੀ ਹਾਂ ਇਸ ਵਿੱਚ ਮੈਨੂੰ ਜ਼ਿਲ੍ਹਾ ਫਾਜ਼ਿਲਕਾ ਪੈਂਦਾ ਹੈ ਮੈਂ ਅਤੇ ਮੇਰੇ ਪਰਿਵਾਰਿਕ ਮੈਂਬਰ ਅਸੀਂ ਅੰਮ੍ਰਿਤਸਰ ਤੀਰਥ ਯਾਤਰਾ 'ਤੇ ਜਾਣਾ ਚਾਹੁੰਦੇ ਹਾਂ ਜਿਸ ਲਈ ਮੈਨੂੰ ਕਾਰ ਨਾ ਹੋਣ ਦੇ ਕਾਰਨ ਮੈਨੂੰ ਆਪਣੀ ਰੇਲ ਗੱਡੀ ਦੀ ਯਾਤਰਾ ਲਈ ਸਮਾਂ ਸਾਰਣੀ ਦੀ ਜ਼ਰੂਰਤ ਸੀ ਕਿਉਂਕਿ ਪਿੰਡ ਵਿੱਚ ਹੋਣ ਕਾਰਨ ਮੈਨੂੰ ਇਸ ਸਟੇਸ਼ਨ ਤੋਂ ਕੋਈ ਬਹੁਤੀ ਜਾਣਕਾਰੀ ਜਾਂ ਵੇਰਵਾ ਪ੍ਰਾਪਤ ਨਹੀਂ ਕਰ ਸਕਿਆ ਸੋ ਮੈਂ ਇਸ ਲਈ ਆਈ ਆਰ ਸੀ ਟੀ ਸੀ ਗਾਹਕ ਸੇਵਾ ਨੂੰ ਕਾਲ ਕਰਕੇ ਇਹ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਅੰਮ੍ਰਿਤਸਰ ਜਾਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਸਮਾਂ ਸਾਰਣੀ ਦੱਸਣ ਦੀ ਜ਼ਰੂਰਤ ਕੀਤੀ ਜਾਵੇ ਕਿਉਂਕਿ ਮੈਂ ਪਹਿਲਾਂ ਤੋਂ ਹੀ ਯੋਜਨਾ ਬਣਾਉਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਜਲਦੀ ਤੋਂ ਜਲਦੀ ਵਾਪਸ ਆਵਾਂ ਤਾਂ ਇੱਕ ਦੋ ਦਿਨ ਦੀ ਯਾਤਰਾ ਕਰਕੇ ਮੈਂ ਉੱਥੋਂ ਵਾਪਸ ਆ ਸਕਦਾ ਹਾਂ ਸੋ ਆਈ ਆਰ ਟੀ ਸੀ ਗਾਹਕ ਸੇਵਾ ਨੇ ਮੈਨੂੰ ਬਹੁਤ ਹੀ ਵਧੀਆ ਢੰਗ ਨਾਲ ਮੇਰੀ ਗੱਲ ਨੂੰ ਸੁਣਿਆ ਅਤੇ ਮੇਰੀ ਸਹਾਇਤਾ ਕੀਤੀ ਜਿਸ ਵਿੱਚ ਉਹਨਾਂ ਤੋਂ ਮੈਂ ਸਮਾਂ ਸਾਰਣੀ ਦੇ ਨਾਲ ਨਾਲ ਰੇਲ ਗੱਡੀ ਦੇ ਜਾਣ ਦੇ ਰਸਤੇ ਕਿਹੜੇ ਕਿਹੜੇ ਸਟੇਸ਼ਨਾਂ 'ਤੇ ਅ ਰੇਲ ਗੱਡੀ ਜਿਹੜੀ ਰੁਕੇਗੀ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਨੇ ਮੈਨੂੰ ਰੇਲ ਗੱਡੀ ਦੇ ਟਾਈਮਿੰਗ ਦੇ ਵਿੱਚ ਮੋਰਨਿੰਗ ਤਿੰਨ ਵਜੇ ਉਸ ਤੋਂ ਬਾਅਦ ਅੱਠ ਵਜੇ ਸਵੇਰੇ ਉਸ ਤੋਂ ਉਪਰੰਤ ਬਾਰਾਂ ਵਜੇ ਦੇ ਲਗਭਗ ਟਰੇਨ ਜੋ ਅੰਮ੍ਰਿਤਸਰ ਨੂੰ ਚੱਲੇਗੀ ਉਸ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਨਾਲ ਉਹਨਾਂ ਮੈਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਜੋ ਰੇਲ ਗੱਡੀ ਅੰਮ੍ਰਿਤਸਰ ਵੱਲ ਜਾਵੇਗੀ ਇਹ ਵਾਇਆ ਫਿਰੋਜ਼ਪੁਰ ਮਫੂ ਜਲੰਧਰ ਹੁੰਦੀ ਹੋਈ ਤਕਰੀਬਨ ਸੁਬਹਾ ਤਿੰਨ ਵਜੇ ਚੱਲਣ ਵਾਲੀ ਰੇਲ ਗੱਡੀ ਦੁਪਹਿਰ ਗਿਆਰਾਂ ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇਗੀ ਤਾਂ ਉਹਨਾਂ ਦੀ ਇਸ ਜਾਣਕਾਰੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਤਾਂ ਮੈਨੂੰ ਉਹਨਾਂ ਦੀ ਇਸ ਸਹਾਇਤਾ ਦੇ ਨਾਲ ਆਉਣ ਜਾਣ ਦੇ ਲਈ ਬਹੁਤ ਵਧੀਆ ਮਦਦ ਮਿਲੀ